ਮੈਂ ਅੰਸ਼ੁਲ ਅਤੇ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਵੈਸੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਵਾਂਗਾ ਕਿ ਪੇਂਟਿੰਗ ਮੇਰਾ ਸ਼ੁਰੂ ਤੋਂ ਹੀ ਇੱਕ ਮਨ ਪਸੰਦੀਦਾ ਪੈਸ਼ਨ ਰਿਹਾ ਅਤੇ ਪਰ ਇਸ ਵਿੱਚ ਮੈਂ ਆਪਣੇ ਸਕੂਲ ਨੂੰ ਵੀ ਇੱਕ ਮਤਲਬ ਕਿ ਸਕੂਲ ਦਾ ਵੀ ਹੱਥ ਮੰਨਣਾ ਕੀ ਜਿਸ ਨੇ ਮੈਨੂੰ ਪੇਂਟਿੰਗ ਨੂੰ ਇੱਕ ਸ਼ੌਂਕ ਵਜੋਂ ਵਿਚਾਰਨ ਲਈ ਬਹੁਤ ਹੀ ਚੰਗੇ ਢੰਗ ਨਾਲ ਪ੍ਰੇਰਿਤ ਕੀਤਾ ਹੈ ਜਿਵੇਂ ਕਿ ਮੈਂ ਪੇਂਟਿੰਗ ਸਬਜੈਕਟ ਵੀ ਚੁਣਿਆ ਸੀ ਆਪਣੇ ਸਕੂਲ ਦੇ ਟਾਈਮ ਅਤੇ ਮੇਰੇ ਸਕੂਲ ਦੇ ਟੀਚਰਾਂ ਨੇ ਮੈਨੂੰ ਪੇਂਟਿੰਗ ਨੂੰ ਇੱਕ ਸ਼ੌਂਕ ਵਜੋਂ ਵਿਚਾਰਨ ਲਈ ਬਹੁਤ ਪ੍ਰੇਰਿਤ ਕੀਤਾ ਅਤੇ ਉਹਨਾਂ ਨੇ ਮੈਨੂੰ ਪੇਂਟਿੰਗ ਵਿੱਚ ਬਹੁਤ ਕੁਝ ਨਵੀਆਂ ਚੀਜ਼ਾਂ ਸੀ ਸਿਖਾਈਆਂ ਜਿਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੈਂ ਸ਼ਾਇਦ ਆਪ ਨਹੀਂ ਸਿੱਖ ਸਕਦਾ ਸੀ ਕਿਉਂਕਿ ਉਹਨਾਂ ਨੇ ਮੈਨੂੰ ਹਰ ਇੱਕ ਢੰਗ ਨਾਲ ਕਿਸ ਢੰਗ ਨਾਲ ਕਿਹੜੀ ਚੀਜ਼ ਕਰਨੀ ਹੈ ਅਤੇ ਕਦੋਂ ਕਰਨੀ ਹੈ ਕਿੱਥੇ ਕਰਨੀ ਆ ਉਹ ਹਰ ਚੀਜ਼ ਸਿਖਾਈ ਹੈ ਅਤੇ ਮੇਰੇ ਖਿਆਲ ਵਿੱਚ ਸਕੂਲ ਦਾ ਤਾਂ ਬਹੁਤ ਵੱਡਾ ਹੱਥ ਹੈ ਕਿ ਮੈਨੂੰ ਪੇਂਟਿੰਗ ਸਿਖਾਉਣ ਵਿੱਚ ਅਤੇ ਬਾਕੀ ਰਹੀ ਗੱਲ ਸਕੂਲ ਦੇ ਟੀਚਰਾਂ ਅਤੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੀ ਪੇਂਟਿੰਗ ਨੂੰ ਹੋਰ ਵਧੀਆ ਢੰਗ ਨਾਲ ਪੇਸ਼ ਕਰਨ 'ਚ ਅਤੇ ਜੇ ਮੈਂ ਗੱਲ ਕਰਾਂ ਪੇਂਟਿੰਗ ਮੁਕਾਬਲਿਆਂ ਦੀ ਉਹਦੇ ਵਿੱਚ ਵੀ ਮੈਂ ਕਾਫੀ ਹਿੱਸਾ ਲਿਆ ਅਤੇ ਉਹਨਾਂ ਨੇ ਮੇਰੀ ਪੇਂਟਿੰਗ ਨੂੰ ਬਹੁਤ ਸਹੀ ਢੰਗ ਨਾਲ ਵੇਖਿਆ ਉਸ ਨੂੰ ਸਾਰਾ ਚੈੱਕ ਕੀਤਾ ਅਤੇ ਬਾਅਦ ਵਿੱਚ ਮੈਨੂੰ ਦੱਸਿਆ ਮੇਰੀ ਗਲਤੀਆਂ ਦੱਸੀਆਂ ਅਤੇ ਹੋਰ ਨਵੀਆਂ ਨਵੀਆਂ ਚੀਜ਼ਾਂ ਸਿਖਾਈਆਂ ਅਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਮੇਰੇ ਸਕੂਲ ਨੇ ਮੈਨੂੰ ਪੇਂਟਿੰਗ ਨੂੰ ਇੱਕ ਸ਼ੌਂਕ ਵਜੋਂ ਵਿਚਰਨ ਲਈ ਬਹੁਤ ਪ੍ਰੇਰਿਤ ਕੀਤਾ ਧੰਨਵਾਦ